ਹੈਲੋ ਹਾਂਜੀ ਦੱਸੋ ਮੈਂ ਤੁਹਾਡੀ ਕਿਸ ਲਈ ਸਹਾਇਤਾ ਕਰ ਸਕਦਾਂ ਇੱਥੇ ਘੁੰਮਣ ਵਾਲੀਆਂ ਬਹੁਤ ਹੀ ਜਗ੍ਹਾ ਹਨ ਜਿਵੇਂ ਕਿ ਇਲਾਂਟੇ ਮੋਲ ਵੀ ਹੈ ਪੰਜਾਬ ਐਂਡ ਬੈਸਟੈਕ ਸੁਖਨਾ ਲੇਕ ਆਦਿ ਐਕਸੈਕਰਾ ਤੁਸੀਂ ਦੱਸੋ ਕਿੱਥੇ ਜਾਣਾ ਇਲਾਂਟੇ ਮੋਲ 'ਚ ਗੋਸਟ ਹਾਊਸ ਵੀ ਹੈਗਾ ਜਿੱਥੇ ਤੁਸੀਂ ਭੂਤੀਆ ਘਰ ਵਿਜ਼ਿਟ ਕਰ ਸਕਦੇ ਹੋ ਉੱਥੇ ਵੱਖ ਵੱਖ ਤਰ੍ਹਾਂ ਦਾ ਤੁਹਾਨੂੰ ਮਾਹੌਲ ਮਿਲ ਜਾਵੇਗਾ ਐਡਵੈਂਚਰ ਮਿਲ ਜਾਵੇਗਾ ਅਤੇ ਸਿਨੇਮਾ ਵੀ ਹੈ ਜਿੱਥੇ ਤੁਸੀਂ ਮੂਵੀਜ਼ ਵੀ ਵੇਖ ਸਕਦੇ ਹੋ ਅਤੇ ਘੁੰਮ ਫਿਰ ਵੀ ਸਕਦੇ ਹੋ ਹਾਂਜੀ ਇਲਾਂਟੇ ਮਹੋਲ ਮੋਲ ਦਾ ਮਾਹੌਲ ਬਹੁਤ ਵਧੀਆ ਹੈ ਇੱਥੇ ਬਹੁਤ ਸਾਰੇ ਲੋਕ ਆਉਂਦੇ ਹਨ ਘੁੰਮਣ ਫਿਰਨ ਲਈ

ਹਾਂਜੀ ਹਾਂ ਇੱਥੇ ਸਾਰੀਆਂ ਵਿਵਸਥਾ ਹੈਗੀਆਂ ਤੁਸੀਂ ਦੱਸੋ ਤੁਹਾਨੂੰ ਕਿਹੜੀ ਵਿਵਸਥਾ ਦੀ ਲੋੜ ਹੈ ਹਾਂਜੀ ਹਾਂ ਵੈਲਕਮ ਵੈਲਕਮ